ਕਸ਼ਮੀਰੀ ਪੰਡਿਤ ਇਤਿਹਾਸ ਵਿੱਚ ਲੜਾਈਆਂ ਦੇ ਹਿੱਸੇ ਵਜੋਂ ਵੱਖ ਵੱਖ ਖੇਤਰਾਂ ਵਿੱਚ ਚਲੇ ਗਏ ਸਨ ਉਹਨਾਂ ਨੂੰ ਉੱਥੇ ਕਈ ਚੁਣੋਤੀਆਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਭੁੱਖਮਰੀ ਬੇਘਰ ਅਤੇ ਨੌਕਰੀਆਂ ਦਾ ਨਾ ਮਿਲਣਾ